ਇੱਕ ਨਾ ਸਾਡੇ ਘਰ ਮਤਲਬ ਕੇ ਬਾੜੀ ਬਣਾਈ ਹੋਈ ਆ ਠੀਕ ਹੈ ਜਿਹਦੇ ਵਿੱਚ ਅਸੀਂ ਸਬਜ਼ੀਆਂ ਵਗੈਰਾ ਲਗਾਉਂਦੇ ਹਾਂ ਅਤੇ ਉਹਦੇ ਵਿੱਚ ਕੀ ਹੁੰਦਾ ਜੀ ਅੱਗੇ ਨਾ ਮਤਲਬ ਬਾੜੀ 'ਚ ਜਿਵੇਂ ਇਹਨੇ ਰੁੱਤ ਵਗੈਰਾ ਟੱਪ ਜਾਂਦੀ ਆ ਜਾਂ ਹੋਰ ਕੁਛ ਹੋ ਜਾਂਦਾ ਜੀ ਇਹਦੇ ਵਿੱਚ ਮਤਲਬ ਵੀ ਚੀਜ਼ ਉਹ ਮਤਲਬ ਬਾੜੀ 'ਚ ਮਤਲਬ ਫੁੱਲ ਵਗੈਰਾ ਜਾਂ ਹੋਰ ਚੀਜ਼ ਸਬਜ਼ੀਆਂ ਵਗੈਰਾ ਵੀ ਸੜ ਜਾਂਦੀਆਂ ਸੀ ਹੋਰ ਉਗਾਉਣ 'ਚ ਪ੍ਰੋਬਲਮ ਆਉਂਦੀ ਸੀ ਮੁੜ ਕੇ ਸਾਨੂੰ ਸਿਆਣੇ ਬੰਦੇ ਬਜ਼ੁਰਗਾਂ ਨੇ ਦੱਸਿਆ ਕਹਿੰਦੇ ਵੀ ਬੇਟਾ ਇਹਦੇ ਵਿੱਚੋਂ ਵੀ ਤੁਸੀਂ ਮਤਲਬ ਕੇ ਵੀ ਤਿਆਰ ਕਰ ਸਕਦੇ ਜਿਵੇਂ ਗੁਲਾਬ ਦੇ ਬੂਟੇ ਕਲਮ ਹੋ ਗਈ ਇਹਨੂੰ ਵੀ ਕੱਟ ਕੇ ਕਲਮ ਇਹਦੀ ਤਿਆਰ ਹੋ ਸਕਦੀ ਹੈ ਠੀਕ ਹੈ ਜੀ ਅਸੀਂ ਇੱਦਾਂ ਲਗਾਉਣ ਲੱਗ ਗਏ ਜੀ ਫਿਰ ਜਿਵੇਂ ਟਮਾਟਰਾਂ ਦੇ ਬੂਟੇ ਹੋ ਗਏ ਜੀ ਇਹਨਾਂ ਵਿੱਚ ਮਤਲਬ ਕਿ ਵੀ ਟਮਾਟਰਾਂ ਦਾ ਜਿਵੇਂ ਇੱਕ ਟਮਾਟਰ ਛੱਡ ਲੈਣਾ ਅਤੇ ਉਹ ਜਦੋਂ ਮਤਲਬ ਉਹਨੇ ਪੱਕ ਜਾਣਾ ਉਹਨਾਂ ਦੇ ਵਿੱਚ ਬੀਜ਼ ਕੱਢ ਕੇ ਜੀ ਅਤੇ ਉਹਦੇ ਬੀਜ਼ ਤੋਂ ਅਤੇ ਮਤਲਬ ਕਿ ਵੀ ਉਹ ਤਿਆਰ ਕਰ ਲੈਣਾ ਬੂਟਾ ਠੀਕ ਹੈ ਜੀ ਇੱਦਾਂ ਤਿਆਰ ਹੋ ਜਾਂਦੇ ਆ ਜਿਵੇਂ ਫਲੀ ਹੋ ਗਈ ਫਲੀ ਦਾ ਵੀ ਇਹਦਾਂ ਐਵੇਂ ਹੀ ਫਲੀਆਂ ਵਗੈਰਾ ਦੇ ਇਹਦੇ ਵਿੱਚ ਵੀ ਮਤਲਬ ਤੁਸੀਂ ਨਾ ਆਪ ਆਪਣਾ ਕੱਟ ਕੇ ਇਹਨੂੰ ਫਲੀਆਂ ਛੱਡ ਦੇਣੀ ਜੇ ਪੱਕ ਜੇ ਇਹਦੇ ਵਿੱਚ ਬੀਜ਼ ਕੱਟ ਕੇ ਅਤੇ ਇਹਦੇ ਵਿੱਚੋਂ ਫਲੀ ਦੇ ਵਿੱਚੋਂ ਬੀਜ਼ ਕੱਢ ਕੇ ਅਤੇ ਤਿਆਰ ਕਰਦੇ ਹੁੰਦੇ ਅਤੇ ਉਹ ਫਲੀ ਉਗਾ ਦਿੰਦੇ ਹਾਂ ਅਤੇ ਉੱਗ ਜਾਂਦੇ ਆ ਵਧੀਆ ਅਤੇ ਵਧੀਆ